ਜਿੱਦਾਂ ਕਿ ਸਾਡੇ ਪਠਾਨਕੋਟ ਵਿੱਚ ਸਰਕਾਰ ਬਹੁਤ ਸਾਰੇ ਕੰਮ ਕਰ ਰਹੀ ਆ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖ ਰਹੀ ਹੈ ਅਤੇ ਇਸੇ ਕਾਰਨ ਸਰਕਾਰ ਨੇ ਨਸ਼ਾ ਛੁਡਾਊ ਕੈਂਪ ਲਗਾਇਆ ਸੀ ਜਿਸ ਵਿੱਚ ਕਾਫੀ ਲੋਕਾਂ ਨੇ ਪਾਰਟੀਸਪੇਟ ਕੀਤਾ ਅਤੇ ਕਈ ਲੋਕਾਂ ਦਾ ਨਸ਼ਾ ਬਹੁਤ ਸਾਰੇ ਲੋਕਾਂ ਨੇ ਛੱਡ ਦਿੱਤਾ ਪਰ ਇਸੇ ਕਾਰਨ ਅਸੀਂ ਦੇਖਦੇ ਹਾਂ ਕਿ ਪਠਾਨਕੋਟ ਬਹੁਤ ਸਾਰੀ ਤਰੱਕੀਆਂ ਕਰ ਰਹੀ ਹੈ ਜਿਵੇਂ ਕਿ ਤੁਸੀਂ ਫ੍ਰੀ ਹੈਲਥ ਕਾਰਡ ਬਾਰੇ ਦੱਸ ਦਿਓ ਪੰਜਾਬ ਵਿੱਚ ਫ੍ਰੀ ਹੈਲਥ ਕਾਰਡ ਬਹੁਤ ਸਾਰੀ ਸੁਵਿਧਾ ਮਿਲਦੀ ਹੈ ਜਿਹਨਾਂ ਲੋਕਾਂ ਦਾ ਬਹੁਤ ਫਾਇਦਾ ਹੋ ਰਿਹਾ ਹੈ ਜੇ ਮੈਂ ਕੋਈ ਹੋਸਪੀਟਲ ਵਿੱਚ ਫ੍ਰੀ ਹੈਲਥ ਕਾਡ ਚੱਲਦੇ ਹਨ ਜਿਹਨਾਂ ਨਾਲ ਲੋਕਾਂ ਦਾ ਲੋਕਾਂ ਦਾ ਬਹੁਤ ਸਾਰਾ ਫਾਇਦਾ ਹੋ ਰਿਹਾ ਫ੍ਰੀ ਦਵਾਈਆਂ ਅਤੇ ਹੋਰ ਕਈ ਮੈਡੀਸਨ ਵਗੈਰਾ ਫ੍ਰੀ ਵਿੱਚ ਮਿਲ ਰਹੀਆਂ ਹਨ ਅਤੇ ਜਦੋਂ ਤੱਕ ਗੱਲ ਕਰੀਏ ਸਾਡੇ ਪਠਾਨਕੋਟ ਪੰਜਾਬ ਵਿੱਚ ਅਤੇ ਬ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਫ੍ਰੀ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਮਹਿਲਾਵਾਂ ਜਿੱਥੇ ਜਾਵੇ ਘੁੰਮ ਸਕਦੀਆਂ ਹਨ ਸਿਰਫ ਉਹਨਾਂ ਨੂੰ ਆਪਣੇ ਆਧਾਰ ਕਾਰਡ ਨਾਲ ਲੈਣ ਦੀ ਦ ਲੋੜ ਹੈ ਹੈਲਥ ਕੈਂਪ ਵੀ ਬਹੁਤ ਸਾਰੇ ਲਗਾਏ ਸੀਗੇ ਸਨ ਜਿਸ ਵਿੱਚ ਬਜ਼ੁਰਗ ਆਦਮੀ ਆਦਿ ਮਾਤਾ ਪਿਤਾ ਆਦਿ ਦਾ ਸਾਰਾ ਚੈੱਕਅਪ ਲਗਾਉਣ ਲਈ ਹੈਲਥ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਬਹੁਤ ਸਾਰੇ ਲੋਕ ਆਏ ਸਨ ਉਹਨਾਂ ਨੇ ਆਪਣਾ ਹੈਲਥ ਗੈਰਾ ਚੈੱਕਅਪ ਕਰਾਇਆ ਸੀ ਇਸੇ ਕਾਰਨ ਅਸੀਂ ਦੇਖਦੇ ਹਾਂ ਕਿ ਪੰਜਾਬ ਸਰਕਾਰ ਬਹੁਤ ਸਾਰੀ ਯੋਜਨਾਵਾਂ ਦਿਖਾ ਰਹੀ ਹੈ ਜਿਸ ਦੇ ਕਾਰਨ ਸਾਡੇ ਪੰਜਾਬ ਦੇ ਲੋਕਾਂ ਨੂੰ ਅਤੇ ਫਾਇਦਾ ਹੋਵੇ ਖ਼ਾਸ ਕਰਕੇ ਪਠਾਨਕੋਟ ਦੇ ਜਿਹੜੇ ਲੋਕ ਹੈ ਬਹੁਤ ਸਰਕਾਰ ਦੇ ਫੈਸਲਿਆਂ ਦੇ ਬਹੁਤ ਪਬੰਦੀ ਨਾਲ ਸੁਣਦੇ ਹਨ ਅਤੇ ਉਹਨਾਂ ਨੂੰ ਸਾਰੇ ਕਿਤੇ ਮੰਨਦੇ ਹਨ ਅਤੇ ਪੰਜਾਬ ਦੀ ਪੁਲੀਸ ਸੁਰੱਖਿਆ ਬਹੁਤ ਚੰਗੀ ਹੈ ਅਤੇ ਜੇ ਲੋਕਾਂ ਨੂੰ ਸਹੀ ਸਲਾਮਤ ਰੱਖਦੀ ਹੈ ਅਤੇ ਪੰਜਾਬ ਸਰਕਾਰ ਕਈ ਪਠਾਨਕੋਟ ਵਿੱਚ ਜੇ ਕੋਈ ਰਾਤ ਨੂੰ ਲੇਟ ਹੋ ਜਾਂਦਾ ਅਤੇ ਉਹਨਾਂ ਨੂੰ ਘਰ ਛੱਡਣ ਦੀ ਡਿਊਟੀ ਪਠਾਨਕੋਟ ਸਰਕਾਰ ਕਰਦੀ ਹੈ ਪਠਾਨਕੋਟ ਦੇ ਬਸ ਸਟੈਂਡ ਹਰ ਇੱਕ ਸੁਵਿਧਾ ਪ੍ਰਾਪਤ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਫਾਇਦਾ ਮਿਲਦਾ ਜਾ ਰਿਹਾ ਹੈ ਅਤੇ ਹੋਸਪੀਟਲ ਆਦਿ ਵਗੈਰਾ ਦਾ ਕੈਂਪ ਲੱਗੇ ਰਹਿੰਦਾ ਹੈ ਧੰਨਵਾਦ